ਹੈਲੋ ਹਾਂਜੀ ਹਾਂਜੀ ਮੈਂ ਫੋਟੋਗ੍ਰਾਫਰ ਬੋਲ ਰਿਹਾਂ ਹਾਂਜੀ ਹੋ ਜਾਊਗਾ ਜੀ ਤੁਹਾਡਾ ਬਜਟ ਕੀ ਆ ਇਹਦੇ 'ਚ ਤਾਂ ਫਿਰ ਮੈਂ ਫੋਟੋ ਹੀ ਖਿੱਚ ਸਕਦਾਂ ਦਸ ਪੰਦਰ੍ਹਾਂ ਵਿਆਹ ਕਿੱਥੇ ਹੈ ਤੁਹਾਡਾ ਹਿਮਾਚਲ ਹੀ ਕਰਵਾਉਣਾ ਕਿੱਥੇ ਕਰਵਾਉਣਾ ਫਿਰ ਲੇਹ ਲੱਦਾਖ ਚੱਲਦੇ ਹਾਂ ਕਸ਼ਮੀਰ ਆਬੂ ਧਾਬੀ ਲੇਹ ਲੱਦਾਖ ਤੁਸੀਂ ਦੱਸੋ ਕਿੰਨੇ ਦਿਨ ਕਰੋਗੇ ਉੱਥੇ ਨਹੀਂ ਤੁਹਾਡੇ ਕੋਲ ਟਾਈਮ ਕਿੰਨੇ ਦਿਨ ਦਾ ਹੈਗਾ ਮੈਂ ਤਾਂ ਰੋਜ਼ ਕਰਦਾ ਰਹੂੰਗਾ ਤਿੰਨ ਦਿਨਾਂ ਦਾ ਹਫ਼ਤਾ ਲੱਗ ਜਾਊਗਾ ਘੱਟੋ ਘੱਟ ਜੇ ਬਹੁਤ ਵਧੀਆ ਕਰਨੀ ਆ ਪੂਰੀ ਬਰੀਕੀ ਨਾਲ ਕਿਉਂਕਿ ਉੱਥੇ ਸਨੋਅ ਵੀ ਹੁੰਦੀ ਹੈ ਫਸ ਫੁਸ ਜਾਵਾਂਗੇ ਆਪਾਂ ਕਿਤੇ ਹਾਂ ਇੱਕ ਦਿਨ ਆਉਣ ਜਾਣ 'ਚ ਲੱਗ ਜਾਣਾ ਫਿਰ ਬਚਿਆ ਕਿੰਨਾ ਚਲੋ ਕੋਈ ਨਹੀਂ ਦੇਖ ਲਵਾਂਗੇ ਆਪਾਂ ਇੱਥੇ ਹੀ ਕਰ ਲੈਂਦੇ ਹਾਂ ਫਿਰ ਮੋਡਲ ਟਾਊਨ 'ਚ ਅੱਛਾ ਮਤਲਬ ਤੁਸੀਂ ਮਤਲਬ ਕੀ ਅਤੇ ਮੇਰਾ ਕੀ ਖਰਚਾ ਪਾਣੀ ਦੇ ਦਓਗੋ ਫਿਰ ਤੁਸੀਂ ਅਤੇ ਖਰਚਾ ਪਾਣੀ ਦੱਸੋਗੇ ਤਾਂ ਹੀ ਦੱਸਾਂਗਾ ਕੁਛ ਹੁਣ ਹਾ ਪੱਚੀ ਹਜ਼ਾਰ ਰੁਪਇਆ ਲੱਗੂਗਾ ਅਤੇ ਰਹਿਣਾ ਅਤੇ ਰਹਿਣਾ ਆਉਣਾ ਜਾਣਾ ਸਭ ਕੁਛ ਤੁਹਾਡਾ ਮੇਰੇ ਵੱਲ ਤੁਸੀਂ ਕਰੋਗੇ ਮੇਰਾ ਪੱਚੀ ਜ਼ਿਆਦਾ ਚਲੋ ਟੂ ਫੋਰ ਟਰਿਪਲ ਨਾਈਨ ਸਹੀ ਆ ਫਿਰ ਮਜ਼ਾਕ ਤਾਂ ਕਰਨ ਦੀ ਆਦਤ ਹੈ ਮੇਰੀ ਇੱਦਾਂ ਹੀ ਮਜ਼ਾਕ ਕੀਤੇ ਸੀ ਚਾਰ ਜਾਣੇ ਇੱਦਾਂ ਹੀ ਮਜ਼ਾਕ ਕਰਕੇ ਚਾਰ ਨਿਆਣੇ ਕਰਤੇ ਮੈਂ ਨਹੀਂ ਨਹੀਂ ਸਾਢੇ ਚੌਵੀ ਫਾਈਨਲ ਹੈ ਤੁਹਾਨੂੰ ਬਹੁਤ ਵਧੀਆ ਰੇਟ ਦਿੱਤਾ ਅਤੇ ਡੇਟ ਕੀ ਹੋਊਗੀ ਕਦੋਂ ਜਾਣ ਜਾ ਕਦੋਂ ਹੋਵੋਗੇ ਤੁਸੀਂ ਫਰੀ ਵਗੈਰਾ ਨੈਕਸਟ ਵੀਕ ਓਕੇ ਅਤੇ ਟਿਕਟ ਵਗੈਰਾ ਤੁਸੀਂ ਕਰ ਲਿਓ ਮੈਂ ਤੁਹਾਨੂੰ ਆਪਣਾ ਨਾਮ ਵਗੈਰਾ ਸਭ ਕੁਛ ਦੱਸ ਦਵਾਂਗਾ ਮੇਰੇ ਨਾਲ ਚਾਰ ਬੰਦੇ ਨਾਲ ਹੋਊਗੇ ਦੋ ਕੁੜੀਆਂ ਦੋ ਮੁੰਡੇ ਉਹਨਾਂ ਦਾ ਖਰਚਾ ਵੀ ਤੁਸੀਂ ਕਰੋਗੇ ਕਿਹਦੀ ਟਿਕਟਾਂ ਦੇ ਪੱਚੀ ਹਜ਼ਾਰ 'ਚ ਉੱਥੇ ਜਾਣ ਦਾ ਈ ਲੱਗ ਜਾਂਦਾ ਤਾਂ ਮੈਂ ਦੇਖ ਕੇ ਹੀ ਦੱਸਿਆ ਤੁਹਾਨੂੰ ਦੇਖੋ ਪੱਚੀ ਹਜ਼ਾਰ ਫੋਟੋ ਵੀਡੀਓ ਬਣਾਉਣ ਦਾ ਪੱਚੀ ਹਜ਼ਾਰ ਬਹੁ ਘੱਟ ਆ ਤੁਸੀਂ ਮਾਰਕੀਟ 'ਚ ਜਾਓ ਰੇਟ ਪੁੱਛੋ ਜ਼ਰਾ ਚਲੋ ਸਾਢੇ ਚੌਵੀ ਡਨ ਤਾਂ ਕੀਤਾ ਜੇ ਚਾਰ ਬੰਦੇ ਹੈਗੇ ਨਾਲ ਖਰਚਾ ਤੁਸੀਂ ਚੁੱਕਣਾ ਸਾਰਾ ਮਤਲਬ ਆਪਾਂ ਪਲੇਨ 'ਚ ਜਾਣਾ ਕਿਵੇਂ ਜਾਣਾ ਪਲੇਨ 'ਚ ਜਾਣਾ ਅਤੇ ਪਾਸਪੋਰਟ ਲੱਗਦਾ ਉੱਥੇ ਜਾ ਨਹੀਂ ਲੱਗਦਾ ਮੈਂ ਬੈਠਾ ਨਹੀਂ ਕਦੇ ਪਲੇਨ 'ਚ ਪਾਸਪੋਰਟ ਨਹੀਂ ਲੱਗਦਾ ਓ ਨਹੀਂ ਬਾਹਰ ਤਾਂ ਲੱਗਦਾ ਜਦੋਂ ਜਾਂਦੇ ਆ ਆਪਾਂ ਵੀਜ਼ਾ ਵੂਜਾ ਵੀ ਲੱਗਦਾ ਕਿਹੜੀ ਫਲਾਈਟ ਕਰਾਓਗੇ ਤੁਸੀਂ ਫਿਰ ਇੰਡੀਗੋ ਜਾਂ ਜਿਹੜੀ ਓ ਸਸਤੀ ਵਾਲੀ ਹੁੰਦੀ ਉਹ ਅਪਰ ਕੁਆਲਟੀ ਨਹੀਂ ਲੋਅਰ ਕੁਆਲਟੀ ਤਾਂ ਆਪਾਂ ਲੈਂਦੇ ਹੀ ਨਹੀਂ ਚਲੋ ਕੋਈ ਨਹੀਂ ਫਿਰ ਤੁਸੀਂ ਕੱਲ੍ਹ ਆ ਜਾਓ ਆਫਿਸ 'ਚ ਮਿਲ ਲਓ ਮੇਰੇ ਨਾਲ ਸਾਰੀ ਡਿਸਕਸ਼ਨ ਕਰ ਲਵਾਂਗੇ ਆਪਾਂ ਉੱਥੇ ਬਹਿ ਕੇ ਉਹ ਹੀ ਮੈਂ ਤੁਹਾਨੂੰ ਲਾਈਵ ਦਿਖਾ ਦਾ ਨਾ ਡੈਮੋ ਕਰਕੇ ਫਿਰ ਲਿਖੋ ਜੀ ਐਡਰੈਸ ਪੰਜ ਬਟਾ ਦੋ ਪੰਜ ਬਟਾ ਦੋ ਬੀ ਆਰ ਨਗਰ ਬਸ ਅੱਗੇ ਇੰਨਾ ਹੀ ਆ ਨਹੀਂ ਗਲੀ 'ਚ ਨਹੀਂ ਰਹਿੰਦੇ ਆਪਾਂ ਚੋੜੀ ਚੌੜੀ ਰੋਡ 'ਤੇ ਰਹਿੰਦੇ ਹਾਂ